ਕੋਈ ਵੀ ਗੀਤ ਗਾਉਂਦੇ ਸਮੇਂ ਸਾਨੂੰ ਆਪਣੇ ਦਰਸ਼ਕਾਂ ਨੂੰ ਆਪਣੇ ਨਾਲ ਜੋੜਨਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਕਿਉਂਕਿ ਜਦੋਂ ਅਸੀਂ ਖੁਦ ਆਪਣੇ ਦਰਸ਼ਕਾਂ ਨੂੰ ਆਪਣੇ ਨਾਲ ਨਹੀਂ ਜੋੜ ਪਾਵਾਂਗੇ ਤਾਂ ਫੇਰ ਦਰਸ਼ਕ ਸਾਡੀ ਗੀਤਕਾਰੀ ਦੇ ਨਾਲ ਖੁਸ਼ ਜਾਂ ਆਨੰਦਮਈ ਨਹੀਂ ਹੋਣਗੇ ਇਸ ਕਰਕੇ ਜਦੋਂ ਵੀ ਮੈਂ ਕੋਈ ਵੀ ਗੀਤ ਗਾਉਂਦੀ ਹਾਂ ਤਾਂ ਮੈਂ ਕੋਸ਼ਿਸ਼ ਕਰਦੀ ਹਾਂ ਕਿ ਆਪਣੀ ਅੱਖਾਂ ਬੰਦ ਕਰਕੇ ਆਪਣੇ ਆਪ ਸਮਝ ਕੇ ਆਪਣੇ ਗੀਤ ਨੂੰ ਉਹਦੇ ਸ਼ਬਦਾਂ ਨੂੰ ਉਹਦੇ ਨਾਲ ਹੇਕ ਲਾ ਕੇ ਗਾਉਂਦੀ ਹਾਂ ਅਤੇ ਆਪਣੇ ਹੱਥਾਂ ਦਾ ਵੱਧ ਤੋਂ ਵੱਧ ਇਸਤੇਮਾਲ ਕਰਦੀ ਹਾਂ ਤਾਂ ਕਿ ਜੋ ਵੀ ਮੈਂ ਸ਼ਬਦ ਬੋਲ ਰਹੀ ਹਾਂ ਉਸਦਾ ਮੈਂ ਆਪਣੇ ਹੱਥਾਂ ਦੇ ਨਾਲ ਆਪਣੇ ਦਰਸ਼ਕਾਂ ਨੂੰ ਚੰਗੀ ਤਰ੍ਹਾਂ ਸਮਝਾ ਸਕਾਂ ਜੇਕਰ ਮੈਂ ਇੰਝ ਨਹੀਂ ਕਰਦੀ ਅਤੇ ਇੱਕ ਥਾਂ ਖੜ੍ਹ ਕੇ ਹੀ ਸਿੰਪਲ ਗਾਉਂਦੀ ਰਹਿੰਦੀ ਹਾਂ ਤਾਂ ਫਿਰ ਮੇਰੇ ਦਰਸ਼ਕ ਵੀ ਬਹੁਤ ਹੀ ਜ਼ਿਆਦਾ ਬੋਰ ਹੋ ਜਾਂਦੇ ਹਨ ਅਤੇ ਉਹਨਾਂ ਨੂੰ ਗੀਤਕਾਰੀ ਦੇ ਵਿੱਚ ਬਹੁਤ ਦਿਲਚਸਪੀ ਨਹੀਂ ਰਹਿੰਦੀ ਸੋ ਮੈਂ ਹਮੇਸ਼ਾ ਹੀ ਕੋਸ਼ਿਸ਼ ਕਰਦੀ ਹਾਂ ਕਿ ਮੈਂ ਆਪਣਾ ਪੂਰਾ ਮਸਤ ਹੋ ਕੇ ਅੱਖਾਂ ਬੰਦ ਕਰਕੇ ਚੰਗੀ ਤਰ੍ਹਾਂ ਆਪਣਾ ਗੀਤ ਗਾਵਾਂ ਅਤੇ ਲੋਕਾਂ ਨੂੰ ਵੱਧ ਤੋਂ ਵੱਧ ਆਪਣੇ ਹੱਥਾਂ ਦਾ ਇਸਤੇਮਾਲ ਕਰਕੇ ਅਤੇ ਆਪਣੇ ਚਿਹਰੇ ਦੇ ਕੁਝ ਕੁ ਖੁਸ਼ੀ ਅਤੇ ਗਮੀ ਦੇ ਹਾਵ ਭਾਵਾਂ ਦੇ ਨਾਲ ਉਹਨਾਂ ਨੂੰ ਸਮਝਾ ਸਕਾਂ ਖੁਸ਼ੀ ਦੇ ਵਿੱਚ ਚਿਹਰੇ ਨੂੰ ਖੁਸ਼ੀ ਦਰਸਾਉਂਦੀ ਹੈ ਅਤੇ ਦੁਖੀ ਦੇ ਵਿੱਚ ਜਦੋਂ ਅਸੀਂ ਦੁਖੀ ਚਿਹਰੇ ਦੇ ਨਾਲ ਬੋਲਦੇ ਹਾਂ ਤਾਂ ਲੋਕ ਵੀ ਸਮਝਦੇ ਹਨ ਦਿਲ ਦੇ ਜਜ਼ਬਾਤਾਂ ਨੂੰ ਇਸ ਤਰ੍ਹਾਂ ਜਦੋਂ ਅਸੀਂ ਗਾਉਂਦੇ ਹਾਂ ਤਾਂ ਫਿਰ ਸਾਡੇ ਦਰਸ਼ਕ ਵੀ ਸਾਡੇ ਨਾਲ ਜੁੜੇ ਰਹਿੰਦੇ ਹਨ ਅਤੇ ਗੀਤਕਾਰੀ ਵੀ ਦਾ ਜੋ ਪ੍ਰਦਰਸ਼ਨ ਉਹ ਵੀ ਚੰਗਾ ਹੁੰਦਾ ਹੈ